ਮੇਰਾ ਨਾਮ ਦੀਪਕ ਸਮਿਆਲ ਹੈ ਮੈਂ ਗੁਰਦਾਸਪੁਰ ਦੇ ਪਿੰਡ ਹੱਲਾ ਦਾ ਨਿਵਾਸੀ ਹਾਂ ਔਰ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਂ ਪੰਜਾਬ 'ਚ ਜਿੰਨੇ ਵੀ ਰਾਈਟਰ ਨੇ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਸਾਰੀਆਂ ਦੀਆਂ ਕਿਤਾਬਾਂ ਪੜ੍ਹੀਆਂ ਜਾਣ ਔਰ ਸਾਡੇ ਗੁਰਦਾਸਪੁਰ ਇੱਕ ਗਗਨ ਬੁੱਕ ਸਟੋਰ ਦੇ ਨਾਮ ਤੋਂ ਇੱਕ ਦੁਕਾਨ ਹੈ ਮੇਰੇ ਮਿੱਤਰ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਉੱਥੇ ਜਾ ਕੇ ਕਿਤਾਬਾਂ ਖਰੀਦ ਸਕਦੇ ਹੋ ਉੱਥੇ ਵਧੀਆ ਕਿਸਮ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਆਈਆਂ ਹੋਈਆਂ ਨੇ ਮੈਂ ਉੱਥੇ ਗਿਆ ਉੱਥੇ ਜਾ ਕੇ ਮੈਂ ਇੱਕ ਕਿਤਾਬ ਖਰੀਦੀ ਜੋ ਕਿ ਕਿਤਾਬ ਸੀ ਸਾਡੇ ਪੰਜਾਬ ਦੇ ਕਾਫੀ ਮਸ਼ਹੂਰ ਲੇਖਕ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਉਹ ਜਦੋਂ ਉਸ ਕਿਤਾਬ ਨੂੰ ਮੈਂ ਪੜ੍ਹਿਆ ਉਸ ਕਿਤਾਬ ਦੇ ਵਿਚਲੀਆਂ ਕਵਿਤਾਵਾਂ ਨੂੰ ਪੜ੍ਹਿਆ ਤਾਂ ਮੈਨੂੰ ਬਹੁਤ ਹੀ ਖੁਸ਼ੀ ਮਿਲੀ ਜਿਵੇਂ ਕਿ ਉਸ ਕਿਤਾਬ ਵਿੱਚ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਪੰਜਾਬ ਦੇ ਲੋਕਾਂ ਦਾ ਕਲਚਰ ਦਿਖਾਇਆ ਗਿਆ ਸੀ ਜਿਸ ਤਰ੍ਹਾਂ ਇੱਕ ਸਾਡੀ ਉਸ ਕਿਤਾਬ ਦੀ ਕਵਿਤਾ ਦਾ ਨਾਮ ਸੀ ਜਵਾਨ ਪੰਜਾਬ ਦੇ ਇੱਕ ਕਵਿਤਾ ਨਾਮ ਸੀ ਖੂਹਾਂ ਉੱਤੇ ਇੱਕ ਕਵਿਤਾ ਦਾ ਨਾਮ ਸੀ ਪੰਜਾਬ ਦੇ ਮਜੂਰ ਪੰਜਾ ਖੂਹਾਂ ਉੱਤੇ ਕਵਿਤਾ ਵਿੱਚ ਉਹਨਾਂ ਨੇ ਬੜਾ ਅੱਛਾ ਦ੍ਰਿਸ਼ ਦੱਸਿਆ ਕਿ ਖੂਹਾਂ ਦੇ ਉੱਤੇ ਕਿਸ ਤਰ੍ਹਾਂ ਮੁਟਿਆਰਾਂ ਜਿਹੜੀਆਂ ਉਹ ਪਾਣੀ ਭਰਦੀਆਂ ਰਾਹ ਜਾਂਦਿਆਂ ਨੂੰ ਪਾਣੀ ਪਿਲਾਉਂਦੀਆਂ ਜਵਾਨ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਜਵਾਨਾਂ ਬਾਰੇ ਗੱਲ ਕੀਤੀ ਸੀ ਪੰਜਾਬ ਦੇ ਜਵਾਨ ਜਿਹੜੇ ਅਣਖੀਲੇ ਨੇ ਅੱਛੇ ਨੇ ਚੋਬਰ ਨੇ ਦੇਸ਼ ਦੀ ਸੇਵਾ ਕਰਦੇ ਨੇ ਔਰ ਪੰਜਾਬ ਦੇ ਮਜੂਰ ਕਵਿਤਾ ਵਿੱਚ ਉਹਨਾਂ ਨੇ ਪੰਜਾਬ ਦੇ ਮਜ਼ਦੂਰਾਂ ਦੇ ਹਾਲਾਤ ਦੱਸੀ ਕਿ ਇਹ ਬੜੇ ਦਿਲ ਦੇ ਸਾਫ਼ ਹੁੰਦੇ ਨੇ ਦਿਲ ਦੇ ਚੰਗੇ ਹੁੰਦੇ ਨੇ ਸੋ ਮੈਨੂੰ ਇਹ ਕਿਤਾਬ ਬਹੁਤ ਅੱਛੀ ਲੱਗੀ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਿਤਾਬ ਨੂੰ ਪੜ੍ਹੋ ਉਹਨਾਂ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਭ ਤੋਂ ਵੱਡੀ ਗੱਲ ਕਿ ਸਾਡੇ ਜੋ ਪੰਜਾਬ ਦਾ ਕਲਚਰ ਆ ਉਹਨਾਂ ਦੇ ਕਲਚਰ ਦੇ ਉੱਤੇ ਆਧਾਰਿਤ ਹੀ ਉਹਨਾਂ ਨੇ ਆਪਣੀਆਂ ਕਵਿਤਾਵਾਂ ਜਿਹੜੀਆਂ ਲਿਖੀਆਂ ਹੋਈਆਂ ਉਹ ਸਾਨੂੰ ਇਹ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਧੰਨਵਾਦ